ਗਰਮੀਆਂ ਵਾਲੇ ਪੌਦੇ ਆ ਜਿਹੜੇ ਗਰਮੀ ਤੋਂ ਫੁੱਲਾਂ ਵਾਲੇ ਪੌਦੇ ਬਹੁਤ ਬਚਾ ਕੇ ਰੱਖਣੇ ਪੈਂਦੇ ਹਨ ਦੋ ਟਾਈਮ ਇਹਨਾਂ ਨੂੰ ਪਾਣੀ ਦੇਣਾ ਪੈਂਦਾ ਅਤੇ ਉੱਤੇ ਛਾਂ ਵੀ ਕਰਨੀ ਪੈਂਦੀ ਹੈ ਅਤੇ ਗੋਡੀ ਅਤੇ ਬਹੁਤ ਇਹਨਾਂ ਨੂੰ ਖੁਰਾਕ ਦੇਖਭਾਲ ਕਰਨੀ ਪੈਂਦੀ ਹੈ ਅਤੇ ਸਰਦੀਆਂ ਦੇ ਵਿੱਚ ਕੋਹਰੇ ਤੋਂ ਬਚਾ ਕੇ ਰੱਖਣਾ ਪੈਂਦਾ ਉਦੋਂ ਵੀ ਇਹਨਾਂ ਨੂੰ ਅਤੇ ਕੋਈ ਜਾਲੀ ਦੀ ਜਾਂ ਕੋਈ ਕਿਸ ਤਰ੍ਹਾਂ ਛਾਂ ਕਰਨੀ ਪੈਂ ਅ ਬਚਾਉਣੇ ਪੈਂਦੇ ਕੋਹਰੇ ਤੋਂ ਅਤੇ ਪਾਣੀ ਉਦੋਂ ਵੀ ਦੇਣਾ ਪੈਂਦਾ ਅਤੇ ਖੁਰਾਕਾਂ ਵੀ ਇਹਨਾਂ ਨੂੰ ਦੇਣੀਆਂ ਪੈਂਦੀਆਂ ਅਤੇ ਗੋਡੀ ਵੀ ਕਰਨੀ ਪੈਂਦੀ ਹੈ ਅਤੇ ਇਸ ਬੱਚਤ ਦੇ ਨਾਲ ਹੀ ਇਹ ਫੁੱਲ ਵਾਲੇ ਪੌਦੇ ਜਿਹੜੇ ਬਚ ਸਕਦੇ ਨੇ ਗੇ ਅਤੇ ਦੂਜੇ ਪੌਦੇ ਨਾਲੋਂ ਇਹ ਬਹੁਤ ਸੋਹਲ ਹੁੰਦੇ ਨੇ ਸੋਹਲ ਦੂਜਿਆਂ ਨੂੰ ਪੌਦਿਆਂ ਨੂੰ ਬਚਾ ਕੇ ਰੱਖਣਾ ਪੈਂਦਾ ਗਰਮੀ ਤੋਂ ਵੀ ਅਤੇ ਸਰਦੀ ਤੋਂ ਵੀ ਅਤੇ ਦੂਜੇ ਪੌਦਿਆਂ ਨਾਲੋਂ ਕਾਫੀ ਸੋਹਲ ਹੁੰਦੇ ਨੇ ਅਤੇ ਦੂਜੇ ਪੌਦਿਆਂ ਦੀ ਤਾਂ ਹਜੇ ਤਾਂ ਦੇਖਭਾਲ ਹਜੇ ਘੱਟ ਕਰੀ ਜਾਊਗੀ ਕੋਈ ਗੱਲ ਨਹੀਂ ਇਹਨਾਂ ਦੀ ਦੇਖਭਾਲ ਜ਼ਿਆਦਾ ਕਰਨੀ ਪੈਂਦੀ ਹੈ ਛਾਂ 'ਚ ਵੀ ਰੱਖਣੇ ਪੈਂਦੇ ਹਨ ਧੁੱਪ ਤੋਂ ਧੁੱਪ 'ਚ ਧੁੱਪ ਤੋਂ ਵੀ ਬਚਾਉਣੇ ਪੈਂਦੇ ਨੇ ਅਤੇ ਸਰਦੀਆਂ ਦੇ ਵਿੱਚ ਇਹਨਾਂ ਨੂੰ ਹਵਾ ਅਤੇ ਧੁੱਪ ਵੀ ਚਾਹੀਦੀ ਹੈ ਅਤੇ ਕੋਹਰੇ ਇਹ ਤੋਂ ਬਚਾ ਕੇ ਰੱਖਣੇ ਪੈਂਦੇ ਨੇ ਗੇ ਇੰਨੀ ਕੁ ਇਹਨਾਂ ਦੀ ਦੇਖਭਾਲ ਬਚਾ ਕੇ ਕਰਨੀ ਪੈਂਦੀ ਹੈ ਅਤੇ ਫਿਰ ਇਹ ਬਚਦੇ ਨੇਗੇ ਅਤੇ ਨਹੀਂ ਸਰਦੀ ਦੇ ਵਿੱਚ ਆ ਕੇ ਵੀ ਇਹ ਪੌਦੇ ਮੱਚਦੇ ਆ ਅਤੇ ਗਰਮੀ 'ਚ ਆ ਕੇ ਵੀ ਮੱਚਦੇ ਆ ਦੇਖਭਾਲ ਵਾਲਾ ਸਹੀ ਸਾਲ ਅੰਤ 'ਤੇ ਜਿਹੜਾ ਇਹਦੀ ਦੇਖਭਾਲ ਕਰਦਾ ਹੈ ਤਾਂ ਹੀ ਇਹ ਬਚ ਸਕਦੇ ਨੇ